ਸ਼ਾਹੀ ਟ੍ਰਾਂਸਪੋਰਟ ਏਜੰਸੀ ਤੋਂ ਬੋਲ ਰਹੇ ਹੋ ਹਾਂਜੀ ਭਾਅ ਜੀ ਮੈਂ ਸ਼ਰਨਪ੍ਰੀਤ ਕੌਰ ਬੋਲ ਰਹੀ ਹਾਂ ਕੱਲ੍ਹ ਮੈਨੇ ਤੁਹਾਡੀ ਟਰਾਂਸਪੋਰਟ ਤੋਂ ਗੱਡੀ ਬੁੱਕ ਕੀਤੀ ਸੀ ਬਰਨਾਲਾ ਤੋਂ ਚੰਡੀਗੜ੍ਹ ਜਾਣ ਲਈ ਮੇਰੇ ਬੱਚਿਆਂ ਨੇ ਚੰਡੀਗੜ੍ਹ ਵਿੱਚ ਘੁੰਮਣਾ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਮੈਨੂੰ ਗੱਡੀ ਵਧੀਆ ਕੰਡੀਸ਼ਨ ਵਿੱਚ ਭੇਜਿਓ ਗੱਡੀ ਪੰਜ ਸੀਟਾਂ ਦੀ ਹੋਵੇ ਗੱਡੀ ਵਿੱਚ ਏ ਸੀ ਚੱਲਦਾ ਹੋਵੇ ਚੰਗਾ ਡਰਾਇਵਰ ਭੇਜਿਓ ਜੋ ਗੱਡੀ ਨੂੰ ਆਰਾਮ ਨਾਲ ਚਲਾਵੇ ਗੱਡੀ ਠੀਕ ਸੱਤ ਵਜੇ ਮੇਰੇ ਘਰ ਪਹੁੰਚ ਜਾਵੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਅੱਗੇ ਤੋਂ ਮੈਂ ਤੁਹਾਡੀ ਟਰਾਂਸਪੋਰਟ ਤੋਂ ਗੱਡੀ ਨਹੀਂ ਬੁੱਕ ਕਰਨੀ ਹੈ ਕਿਉਂਕਿ ਜੋ ਤੁਹਾਨੂੰ ਕਿਹਾ ਸੀ ਉਹ ਕੁਝ ਵੀ ਨਹੀਂ ਹੋਇਆ ਭਾਵ ਸਾਰਾ ਕੁਛ ਇਸ ਤੋਂ ਉਲਟ ਹੋਇਆ ਪਹਿਲੀ ਗੱਲ ਡਰਾਈਵਰ ਇੱਕ ਘੰਟਾ ਲੇਟ ਆਇਆ ਦੂਸਰੀ ਗੱਡੀ ਵੀ ਦੇਖਣ 'ਚ ਜ਼ਿਆਦਾ ਵਧੀਆ ਨਹੀ ਲੱਗਦੀ ਸੀ ਨਾ ਹੀ ਉਸ ਦਾ ਏ ਸੀ ਚੱਲਦਾ ਸੀ ਗੱਡੀ ਵਿੱਚ ਵਾਈਵਰੇਸ਼ਨ ਕਾਫੀ ਹੋ ਰਹੀ ਸੀ ਰਸਤੇ ਵਿੱਚ ਇਸ ਗੱਡੀ ਦਾ ਦੋ ਵਾਰ ਟਾਇਰ ਪੈਂਚਰ ਹੋਇਆ ਡਰਾਇਵਰ ਵੀ ਗੱਡੀ ਨੂੰ ਆਰਾਮ ਨਾਲ ਨਹੀਂ ਚਲਾਉਂਦਾ ਸੀ ਮੇਰੇ ਬੱਚਿਆਂ ਨੇ ਚੰਡੀਗੜ੍ਹ ਵਿੱਚ ਪੰਜ ਜਗ੍ਹਾ 'ਤੇ ਘੁੰਮਣਾ ਸੀ ਪਰ ਉਹ ਸਿਰਫ ਦੋ ਜਗ੍ਹਾ 'ਤੇ ਹੀ ਘੁੰਮ ਸਕੇ ਅਸੀਂ ਤੁਹਾਡੀ ਸਾਰੀ ਪੇਮੈਂਟ ਐਡਵਾਂਸ ਹੀ ਕਰ ਦਿੱਤੀ ਸੀ ਤਾਂ ਜੋ ਸਾਨੂੰ ਸਰਵਿਸ ਵਧੀਆ ਮਿਲੇ ਪਰ ਸਾਡੇ ਨਾਲ ਬਹੁਤ ਬੁਰਾ ਹੋਇਆ